ਪੰਜਾਬੀ ਭਾਸ਼ਾ ਫਾਰਸੀ ਸ਼ਬਦ ਦੇ ਦੋ ਸ਼ਬਦਾਂ ਦੇ ਸੁਮੇਲ ਤੋਂ ਬਣਿਆ ਇਹ ਗਿਣਤੀ ਦੇ ਪੰਜ ਅੱਖਰ ਹੁੰਦੇ ਹਨ ਪੰਜ ਆਬ ਦੀ ਧਰਤੀ ਹੈ ਪੰਜਾਬ ਇਸ ਤਰ੍ਹਾਂ ਪੰਜਾਬ ਸ਼ਬਦ ਦਾ ਅਰਥ ਪੰਜਾਂ ਪੰਜਾਂ ਦਰਿਆਵਾਂ ਦੀ ਧਰਤੀ ਤੋਂ ਪਿਆ ਹੈ ਪੁਰਾਤਨ ਸੱਭਿਆਚਾਰਕ ਸੋਮਿਆਂ ਵਿੱਚ ਇੱਕ ਸ਼ਬਦ ਪੰਚ ਨਦਵੀ ਸ਼ਾਮ ਸ਼ਾਮਿਲ ਸੀ ਜਿਹੜਾ ਪੰਜਾਬ ਦਾ ਹੀ ਪਰਿਅਵਾਚੀ ਸੀ ਅਤੇ ਉਸ ਖਿੱਤੇ ਲਈ ਵਰਤਿਆ ਜਾਂਦਾ ਸੀ ਨਿਸ਼ਚਿਤ ਭੂਗੋਲਿਕ ਖਿੱਤਾ ਵਿਸ਼ੇਸ਼ ਜੀਵਨ ਢੰਗ ਅਤੇ ਭਾਸ਼ਾ ਮਿਲ ਕੇ ਹੀ ਕਿਸੇ ਸ਼ਭ ਸੱਭਿਆਚਾਰ ਨੂੰ ਪ੍ਰਭਾਵਿਤ ਕਰਦੇ ਹਨ ਵੈਸੇ ਵੀ ਜਦੋਂ ਕੋਈ ਆਪਣੇ ਸੱਭਿਆਚਾਰ ਦੇ ਦੇ ਭੂਗੋਲਿਕ ਚੋਗਾਠੇ ਨੂੰ ਛੱਡ ਕੇ ਕਿਸੇ ਦੂਜੇ ਸੱਭਿਆਚਾਰ ਦੇ ਭੂਗੋਲਿਕ ਚੌਕਠੇ ਵਿੱਚ ਚਲਾ ਜਾਂਦਾ ਹੈ ਤਾਂ ਉਹਦਾ ਸੱਭਿਆਚਾਰਕ ਲੈਣ ਦੇਣ ਕਰਮ ਪ੍ਰਤੀਕਰਮ ਉੱਥੋਂ ਦੇ ਸੱਭਿਆਚਾਰ ਨਾਲ ਸ਼ੁਰੂ ਹੋ ਜਾਂਦਾ ਹੈ ਨਿਸ਼ਚਿਤ ਭੂਗੋਲਿਕ ਚੌਕਠ ਤੋਂ ਬਿਨਾਂ ਅਸੀਂ ਸੱਭਿਆਚਾਰ ਦੀ ਕਲਪਨਾ ਨਹੀਂ ਕਰ ਸਕਦੇ ਅਤੇ ਭੂਗੋਲਕ ਚੌਕਠਾ ਨਿਸ਼ਚਿਤ ਕਰਨ ਵੇਲੇ ਅਸੀਂ ਸਮਕਾਲੀ ਯਥਾਰਥ ਨੂੰ ਅੱਖੋਂ ਓਹਲੇ ਨਹੀਂ ਕਰ ਸਕਦੇ ਇਸ ਲਈ ਅੱਜ ਦੀਆਂ ਹਾਲਾਤਾਂ ਵਿੱਚ ਅਸੀਂ ਪੰਜਾਬੀ ਸੱਭਿਆਚਾਰ ਦਾ ਭੂਗੋਲਿਕ ਚੌਕਠਾ ਉਹੀ ਮੰਨਾਂਗੇ ਜੋ ਇਸ ਵੇਲੇ ਭਾਰਤੀ ਪੰਜਾਬੀ ਦਾ ਹਿੱਸਾ ਹੈ ਬਾਕੀ ਸਾਰਾ ਇਸ ਦਾ ਇੱਥੋਂ ਤੱਕ ਪੁੱਜਣ ਦਾ ਇਤਿਹਾਸ ਹੈ ਪੁਰਾਤਨ ਸੱਭਿਆਚਾਰਕ ਸੋਮਿਆਂ ਵਿੱਚ ਪੰਜਾਬੀ ਭਾਸ਼ਾ ਦਾ ਅਰਥ ਕੁਛ ਹੋਰ ਮਿਥਿਆ ਜਾਂਦਾ ਸੀ ਪਰ ਵਰਤਮਾਨ ਯੁੱਗ ਦੇ ਵਿੱਚ ਇਸ ਭਾਸ਼ਾ ਦਾ ਅਰਥ ਹੋਰ ਕੁਝ ਮੰਨਿਆ ਜਾ ਰਿਹਾ ਇਤਿਹਾਸ ਵੀ ਗਵਾਹ ਹੈ ਕਿ ਪੰਜਾਬ ਨੇ ਬਹੁਤ ਦੂਰ ਦੂਰ ਤੱਕ ਮੱਲਾਂ ਮਾਰੀਆਂ ਹਨ ਕੋਈ ਸਰਬ ਕਾਲੀ ਪਰ ਸਮਾਜਿਕ ਭਾਵਵਾਚੀ ਸੰਕਲਪ ਨਹੀਂ ਸਗੋਂ ਸਮੇਂ ਅਤੇ ਸਥਾਨ ਦੀਆਂ ਸੀਮਾ ਵਿੱਚ ਹੀ ਅਰਥ ਹਨ ਇਤਿਹਾਸ ਦੇ ਦੌਰਾਨ ਇੱਕ ਖਿੱਤੇ ਵਿੱਚ ਇੱਕ ਦੂਜੇ ਦੀ ਥਾਂ ਲੈਂਦੇ ਹੋਏ ਵੱਖੋ ਵੱਖਰੇ ਸੱਭਿਆਚਾਰ ਹੋ ਸਕਦੇ ਹਨ ਸੱਭਿਆਚਾਰ ਦੇ ਅਧਿਐਨ ਵਿੱਚ ਇਸ ਗੱਲ ਨੂੰ ਧਿਆਨ ਵਿੱਚ ਰੱਖਿਆ ਜਾਣਾ ਚਾਹੀਦਾ ਹੈ ਪਰ ਸਭਿਆ ਸੰਯੁਕਤ ਸੱਭਿਆਚਾਰਕ ਦਾ ਮਤਲਬ ਸੱਭਿਆਚਾਰ ਸੱਭਿਆਚਾਰ ਗੱਗਾ ਸੱਭਿਆਚਾਰ ਹੀ ਨਹੀਂ ਹੁੰਦਾ ਇਸ ਦਾ ਮਤਲਬ ਇਹ ਹੁੰਦਾ ਹੈ ਕਿ ਸੱਭਿਆਚਾਰ ਇਸ ਦੇ ਉਪ ਸੱਭਿਆਚਾਰ ਹਨ ਜਾਂ ਇਹਨਾਂ ਦੀ ਅੱਜ ਭਰਪੂਰ ਮਾਤਰਾ ਵਿੱਚ ਸੱਭਿਆਚਾਰ ਸੰਯੁਕਤ ਸੱਭਿਆਚਾਰ ਵਿੱਚ ਮਿਲਦੇ ਹਨ ਜੋ ਇਹ ਇੱਕਜੁੱਟ ਸਿਸਟਮ ਵਜੋਂ ਹੋਂਦ ਰੱਖਦੇ ਹਨ ਦੂਜੀ ਗੱਲ ਪੰਜਾਬੀ ਸੱਭਿਆਚਾਰ ਅਤੇ ਪੰਜਾਬ ਦੇ ਸੱਭਿਆਚਾਰ ਇੱਕ ਚੀਜ਼ ਨਹੀਂ ਬਿਲਕੁਲ ਜਿਸ ਤਰ੍ਹਾਂ ਪੰਜਾਬੀ ਸਾਹਿਤ ਅਤੇ ਪੰਜਾਬ ਦਾ ਸਾਹਿਤ ਦੋ ਵੱਖੋ ਵੱਖਰੀਆਂ ਚੀਜ਼ਾਂ ਹਨ ਪੰਜਾਬ ਦੇ ਸਾਹਿਤ ਦੀ ਗੱਲ ਅਸੀਂ ਬੇਸ਼ੱਕ ਰਿਗਵੇਦ ਤੋਂ ਵੀ ਸਮਝ ਸਕਦੇ ਹਾਂ ਪਰ ਇਸ ਵਿੱਚ ਉਹ ਸਾਹਿਤ ਵੀ ਸ਼ਾਮਿਲ ਕਰ ਸਕਦੇ ਹਾਂ ਜਿਹੜੇ ਪੰਜਾਬੀ ਵਿੱਚ ਨਹੀਂ ਪਰ ਪੰਜਾਬ ਵਿੱਚ ਜਾਂ ਪੰਜਾਬੀਆਂ ਵਿੱਚੋਂ ਰਚੇ ਗਏ ਹਨ